ਸਾਡੇ ਇਲਾਕੇ ਵਿੱਚ ਲਗਭਗ ਸਾਰੇ ਹੀ ਅਖ਼ਬਾਰ ਆਉਂਦੇ ਹੈ ਜਿਵੇਂ ਅਜੀਤ ਪੰਜਾਬੀ ਟ੍ਰਿਬਿਊਨ ਜਗਬਾਣੀ ਦੈਨਿਕ ਜਾਗਰਣ ਦੈਨਿਕ ਭਾਸਕਰ ਦੇਸ਼ ਸੇਵਕ ਅਤੇ ਆਦਿ ਅਤੇ ਇਹਨਾਂ ਵਿੱਚੋਂ ਜਿਹੜਾ ਮੇਰਾ ਮੇਨ ਪਸੰਦੀਦਾ ਅਖ਼ਬਾਰ ਆ ਉਹ ਦੈਨਿਕ ਭਾਸਕਰ ਹੈ ਅਤੇ ਇਹਦੇ ਵਿੱਚ ਮੈਂ ਜੋ ਦੇਸ਼ ਵਿਦੇਸ਼ ਕੌਲਮ ਹੈ ਮੈਂ ਉਹਨੂੰ ਜ਼ਿਆਦਾ ਮੇਰਾ ਇੰਟਰਸਟ ਆਉਂਦਾ ਹੈ ਕਿਉਂਕਿ ਉਹ ਦੇ ਵਿੱਚ ਕੇਵਲ ਦੇਸ਼ ਦੀਆਂ ਖ਼ਬਰਾਂ ਨਹੀਂ ਬਲਕਿ ਬਾਹਰ ਦੀਆਂ ਖ਼ਬਰਾਂ ਵੀ ਹੁੰਦੀਆਂ ਅਤੇ ਮੈਂ ਵਰਲਡ ਨਾਲ਼ ਕਨੈਕਟ ਹੋਣਾ ਪਸੰਦ ਕਰਦਾ ਆਈ ਥਿੰਕ ਸ਼ਾਇਦ ਇਸ ਲਈ ਮੈਨੂੰ ਵਧੀਆ ਲੱਗਦਾ ਹੈ ਅਤੇ ਦੂਜੇ ਨੰਬਰ 'ਤੇ ਇੱਕ ਜਗਬਾਣੀ ਅਖ਼ਬਾਰ ਵੀ ਮੈਨੂੰ ਬਾਹਲਾ ਮੈਂ ਕਾਫ਼ੀ ਪਸੰਦ ਕਰਦਾ ਉਹਦੇ ਵਿੱਚ ਅਸ਼ਵਨੀ ਕੁਮਾਰ ਜੀ ਦੇ ਇੱਕ ਲੇਖ ਆਉਂਦਾ ਹੁੰਦਾ ਹੈ ਉਹ ਮੈਨੂੰ ਬਹੁਤ ਪਸੰਦ ਹੈ ਕਿਉਂਕਿ ਉਹ ਘੱਟ ਸ਼ਬਦਾਂ 'ਚ ਬਹੁਤੀ ਗੱਲ ਕਹਿੰਦੇ ਆ ਨਹੀਂ ਦੁਨੀਆਂ ਦਾ ਕੀ ਹੁੰਦਾ ਬਹੁਤੇ ਸ਼ਬਦ ਹੁੰਦੇ ਹੈ ਅਤੇ ਗੱਲ ਘੱਟ ਹੁੰਦੀ ਏ ਇਸ ਲਈ ਟੋਪ ਮੋਸਟ ਮਾਈ ਫੇਵਰੇਟ ਜੋ ਅਖ਼ਬਾਰ ਹੈ ਉਹ ਹੈ ਦੈਨਿਕ ਭਾਸਕਰ ਧੰਨਵਾਦ